ਹਾਂਜੀ ਤੁਸੀਂ ਚੰਦਰ ਜੀ ਬੋਲ ਰਹੇ ਹੋ ਹਾਂਜੀ ਤੁਸੀਂ ਐਨਰਜੀ ਮੀਟਰ ਚੈਕਿੰਂਗ ਦਾ ਕੰਮ ਹੈ ਤੁਹਾਡਾ ਹਾਂਜੀ ਮੈਂ ਦੋ ਕੰਪਲੇਂਟਸ ਕਰਨੀਆਂ ਸੀ ਕਿ ਮੇਰੇ ਦੋ ਤਿੰਨ ਫਲੈਟਸ ਪ੍ਰੋਪਰਟੀ ਹੈਗੀਆਂ ਨੇ ਅਲੱਗ ਅਲੱਗ ਏਰੀਏ ਵਿੱਚ ਹਾਂਜੀ ਬਸਤੀ ਹਜੂਰ ਸਿੰਘ ਵਿਜੇ ਕਲੋਨੀ ਹਾਂ ਉਹ ਮੈਂ ਸਾਰੀ ਪ੍ਰੋਪਰਟੀ ਜਿਹੜੀ ਹੈਗੀ ਨਾ ਆਪਣੀ ਰੈਂਟ 'ਤੇ ਦੇਣੀ ਏ ਅਤੇ ਉਹਨਾਂ ਦੇ ਮੀਟਰ ਵਿੱਚ ਕੁਛ ਪ੍ਰੋਬਲਮ ਆ ਰਹੀ ਹੈ ਹਾਂਜੀ ਪਰ ਉਹ ਪਹਿਲੇ ਚੈਕ ਕਰਨਾ ਪਏਗਾ ਤਾਂ ਮੈਂ ਰੈਂਟ 'ਤੇ ਦੇ ਸਕਾਂਗੀ ਅਤੇ ਮੈਨੂੰ ਉਹ ਜਲਦੀ ਚਾਹੀਦੇ ਕਿ ਤੁਸੀਂ ਉਹਨੂੰ ਚੈੱਕ ਕਰ ਜਾਓ ਆ ਕੇ ਅਤੇ ਮੈਂ ਉਹਨੂੰ ਰੈਂਟ 'ਤੇ ਕਰ ਸਕਾਂ ਹਾਂਜੀ ਅਲੱਗ ਅਲੱਗ ਦੋ ਏਰੀਏ ਵਿੱਚ ਹੈ ਜੀ ਹਾਂਜੀ ਬਸਤੀ ਹਜੂਰ ਸਿੰਘ ਇਕ ਤਰੀਕ ਤੋਂ ਮੈਂ ਉਹਨੂੰ ਮਾਰ ਰੈਂਟ 'ਤੇ ਦੇਣਾ ਅਤੇ ਕੋਸ਼ਿਸ਼ ਕਰੋ ਇੱਕ ਦੋ ਦਿਨਾਂ ਦੇ ਵਿੱਚ ਆ ਕੇ ਉਹਨੂੰ ਕਰ ਜਾਓ ਕੋਸ਼ਿਸ਼ ਕਰੋ ਇੱਕ ਦਿਨ ਵਿੱਚ ਆ ਕੇ ਕਰ ਜੋ ਤਾਂ ਮੈਂ ਆਪਣੀ ਪ੍ਰੋਪਰਟੀ ਹਾਂਜੀ ਰੈਂਟ 'ਤੇ ਕਰ ਸਕਾਂ ਹਾਂਜੀ ਹਾਂਜੀ ਠੀਕ ਹੈ ਜੀ ਜਲਦੀ ਦੱਸਣਾ ਹਾਂਜੀ ਥੈਂਕ ਯੂ